ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਜਲੰਧਰ ਤੋਂ ਬੋਲਦੀ ਹਾਂ ਅਸੀਂ ਆਉਣਾ ਸੀਗਾ ਦੁਕਾਨ 'ਤੇ ਆਉਣਾ ਸੀਗਾ ਐਕਚੁਲੀ ਸਾਡੇ ਨਾ ਵਿਆਹ ਆ ਇਧਰ ਘਰ ਅਤੇ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਇੱਥੇ ਅ ਸ਼ੋਪ ਹੈਗੀ ਹੈ ਕੈਂਟ ਦੇ ਵਿੱਚ ਬਹੁਤ ਵਧੀਆ ਹਰ ਵਿਰਾਇਟੀ ਦੇ ਇੱਥੇ ਸੂਟ ਮਿਲਦੇ ਆ ਹਾਂਜੀ ਹਾਂਜੀ ਹਾਂਜੀ ਸੂਟਾਂ ਵਾਸਤੇ ਅਸੀਂ ਹਾਂਜੀ ਹਾਂ ਵਿਆਹ ਵਾਸਤੇ ਚਾਹੀਦੇ ਸੀ ਜਿੱਦਾਂ ਵਰੀ ਦੇ ਲੈਣ ਦੇਣ ਦੇ ਸਾਰੇ ਤਰ੍ਹਾਂ ਦੇ ਹਰ ਤਰ੍ਹਾਂ ਦੇ ਸੂਟ ਹਾਂਜੀ ਅੱਛਾ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਮੈਮ ਅੱਜ ਕੱਲ੍ਹ ਤਾਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਕੁੜੀਆਂ ਸਿੰਪਲ 'ਤੇ ਸੋਬਰ ਹੀ ਜ਼ਿਆਦਾ ਸੂਟ ਪਾ ਕੇ ਖੁਸ਼ ਹੈ ਹੈ ਨਾ ਤਾਂ ਉਸ ਤਰ੍ਹਾਂ ਦੀ ਹੁਣ ਵਿਰਾਇਟੀ ਅੱਛੀ ਹੋਵੇ ਹਾਂਜੀ ਹੈਵੀ ਹੋਵੇ ਹਾਂਜੀ ਹਾਂਜੀ ਹਾਂਜੀ ਥੋੜ੍ਹਾ ਹੈਵੀ ਹੋਵੇ ਬੱਟ ਡੀਸੈਂਟ ਜਿਹੇ ਕਲਰ ਹੋਣ ਹੈ ਨਾ ਕਿਉਂਕਿ ਵਧੀਆ ਲੱਗੇ ਸੂਟ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਜਿੱਦਾਂ ਅਸੀਂ ਵਿਆਹ ਵਾਸਤੇ ਲੈਣੇ ਹੈ ਉਹ ਤਾਂ ਕੁੜੀ ਵਾਸਤੇ ਲੈਣੇ ਹੈ ਅਤੇ ਉਹ ਤਾਂ ਚੱਲੋ ਅਸੀਂ ਲਵਾਂਗੇ ਵਧੀਆ ਲਵਾਂਗੇ ਹੈਨਾ ਬ੍ਰਾਈਟ ਕਲਰ ਹੀ ਲਵਾਂਗੇ ਜਿੱਦਾਂ ਬਾਕੀ ਸਾਡੀ ਫੈਮਿਲੀ ਨੇ ਵੀ ਲੈਣੇ ਆ ਹਾਂਜੀ ਹਾਂਜੀ ਰਿਸ਼ਤੇਦਾਰ ਅਸੀਂ ਖੁਦ ਲੀ ਵੀ ਲੈਣੇ ਆ ਹੈ ਨਾ ਹਾਂਜੀ ਖੁਦ ਲਈ ਵੀ ਲੈਣੇ ਆ ਉਸ ਉਸ ਹਿਸਾਬ ਨਾਲ ਮੈਂ ਕਹਿ ਰਹੀ ਸੀਗੀ ਪੀ ਚਲੋ ਹੈ ਨਾ ਇਹ ਵਧੀਆ ਕੱਪੜਾ ਹਾਂ ਹਾਂਜੀ ਅੱਛਾ ਅੱਛਾ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹੁਣ ਜਿੱਦਾਂ ਚਲੋ ਸਰਦੀਆਂ ਦਾ ਹੈ ਨਾ ਵਿਆਹ ਆ ਤਾਂ ਚਲੋ ਉਹ ਤਾਂ ਅਸੀਂ ਫੰਕਸ਼ਨ ਵਾਸਤੇ ਤਾਂ ਲਵਾਂਗੇ ਇਸ ਤਰ੍ਹਾਂ ਸਿਲਕ ਵਗੈਰਾ ਦੇ ਹੀ ਅਤੇ ਉੱਦਾਂ ਨੋਰਮਲ ਜਿੱਦਾਂ ਘਰ ਪਾਉਣ ਦੇ ਲਈ ਸਾਨੂੰ ਚਾਹੀਦੇ ਸੀ ਜਿੱਦਾਂ ਹੈ ਨਾ ਵਧੀਆ ਵਧੀਆ ਦੇ ਵਿੱਚ ਹਾਂਜੀ ਵੈਲਵਟ ਦੇ ਹੋ ਜਾਣ ਪਸ਼ਮੀਨਾ ਵਧੀਆ ਪਸ਼ਮੀਨੇ ਦੇ ਹਾਂਜੀ ਵਧੀਆ ਪਸ਼ਮੀਨੇ 'ਚ ਸੂਟ ਹੋ ਜਾਣ ਸ਼ੋਲ ਵਾਲੇ ਜਿੱਦਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਹੀ ਮੈਂ ਕਹਿ ਹ ਹਾਂਜੀ ਹਾਂਜੀ ਬਸ ਇਸ ਤਰ੍ਹਾਂ ਦੇ ਅਸੀਂ ਕਿਹਾ ਸੀ ਵੀ ਚਲੋ ਸਾਨੂੰ ਦੱਸਿਆ ਸੀ ਤੁਹਾਡੀ ਦੁਕਾਨ ਦੇ ਬਾਰੇ ਕਿਸੇ ਨੇ ਤਾਂ ਮੈਂ ਕਿਹਾ ਚਲੋ ਪਹਿਲਾਂ ਇੱਕ ਵਾਰ ਫੋਨ 'ਤੇ ਗੱਲ ਕਰਕੇ ਮੈਂ ਕਿਹਾ ਹਾਂਜੀ ਹਾਂਜੀ ਮੈਂ ਕਿਹਾ ਪਹਿਲਾਂ ਇੱਕ ਵਾਰ ਫੋਨ 'ਤੇ ਗੱਲ ਕਰਕੇ ਫਿਰ ਮੈਂ ਕਿਹਾ ਜਾਵਾਂਗੇ ਅਤੇ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ

ਅੱਛਾ ਅੱਛਾ ਅੱਛਾ ਠੀਕ ਹੈ ਸਾਨੂੰ ਤਾਂ ਇਨ੍ਹਾਂ ਨੇ ਨੰਬਰ ਹੀ ਦਿੱਤਾ ਸੀ ਫੋਨ ਕਰਕੇ ਪੁੱਛ ਲਿਓ ਵੈਸੇ ਤੁਹਾਡੀ ਕਿੱਥੇ ਕੁ ਦੁਕਾਨ ਪੈਂਦੀ ਸਾਨੂੰ ਦੱਸ ਸਕਦੇ ਮਾੜਾ ਜਿਹਾ ਥੋੜ੍ਹਾ ਜਿਹਾ ਆਈਡਿਆ ਹੋ ਜਾਂਦਾ ਫਿਰ ਅਸੀਂ ਆਉਣਾ ਸੀਗਾ

ਹਾਂਜੀ

ਅੱਛਾ ਜੀ ਠੀਕ ਹੈ ਅੱਛਾ ਜੀ ਹਾਂਜੀ ਹਾਂਜੀ ਮੈਮ ਅਸੀਂ ਹਾਂਜੀ ਉਹ ਸਾਨੂੰ ਇਹ ਹੀ ਸੀਗਾ ਵੀ ਇੱਕ ਹੀ ਦੁਕਾਨ ਸਾਨੂੰ ਵਾਰ ਵਾਰ ਨਾ ਇਧਰ ਉੱਧਰ ਦੁਕਾਨਾਂ 'ਤੇ ਨਾ ਜਾਣਾ ਪਵੇ ਸਾਨੂੰ ਇੱਕ ਹੀ ਦੁਕਾਨ ਤੋਂ ਹੀ ਸਾਰਾ ਸਮਾਨ ਅਸੀਂ ਲਈਏ ਹੈ ਨਾ ਸੂਟ ਵਗੈਰਾ ਇੱਕ ਹੀ ਦੁਕਾਨ ਤੋਂ ਲੈ ਹੋ ਜਾਣ ਤਾਂ ਵਧੀਆ ਰਹਿੰਦਾ ਹੈ ਨਾ ਅਤੇ ਇਹ ਨਹੀ ਵੀ ਇਹ ਇੱਕ ਤੋਂ ਹਾਂਜੀ ਹਾਂਜੀ ਹਾਂਜੀ ਉਹ ਹੀ ਤਾਂ ਗੱਲ ਹੈ ਨਾ ਵੀ ਸਾਨੂੰ ਇੱਕ ਹੀ ਦੁਕਾਨ ਤੋਂ ਸਾਰੇ ਤਰ੍ਹਾਂ ਦੀ ਵਿਰਾਇਟੀ ਮਿਲ ਜਾਵੇ ਤਾਂ ਕਰਕੇ ਸਾਨੂੰ ਨੰਬਰ ਦਿੱਤਾ ਸੀਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਲੇਡੀਜ ਸੂਟ ਤਾਂ ਚਲੋ ਹੋ ਗਿਆ ਜੈਂਟਸ ਕੱਪੜੇ ਵੀ ਮਿਲ ਜਾਂਦੇ ਹੈ ਜਿੱਦਾਂ ਠੀਕ ਹੈ ਕੋਟ ਪੈਂਟ ਹਾਂਜੀ ਕੱਪੜਾ ਵਗੈਰਾ ਜਿੱਦਾਂ ਮਿਲ ਸਕਦਾ ਹੈ ਨਾ ਕੋਟ ਪੈਂਟ ਕੱਪੜਾ ਵਗੈਰਾ ਮਿਲ ਸਕਦਾ ਹੈ ਅੱਛਾ ਅੱਛਾ ਪੈਂਟ ਸ਼ਰਟਸ ਵਗੈਰਾ ਠੀਕ ਹਾਂਜੀ ਸਟਿਚਿੰਗ ਵਾਲਾ ਹਾਂਜੀ ਠੀਕ ਹੈ ਸਾਨੂੰ ਇਹ ਹੀ ਹੈ ਨਾ ਵੀ ਚਲੋ ਹੈ ਨਾ ਹਾਂਜੀ ਹਾਂਜੀ ਬ੍ਰਾਈਡਲ ਹਾਂਜੀ ਹਾਂਜੀ ਬ੍ਰਾਈਡਲ ਵੀ ਮਿਲ ਜਾਏਂਗੇ ਜਿੱਦਾਂ ਲਹਿੰਗਾ ਵਗੈਰਾ ਬੁੱਕ ਕਰਵਾਉਣਾ ਹੋਵੇ ਹੈ ਨਾ ਉਹ ਵੀ ਸਾਰਾ ਕੁਛ ਮਿਲ ਜਾਵੇਗਾ ਇੱਥੋਂ ਠੀਕ ਹੈ ਹਾਂਜੀ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਫਿਰ ਅਸੀਂ ਹੈ ਨਾ ਆਵਾਂਗੇ ਕਿਸੇ ਦਿਨ ਦਿਨ ਜਿਹਾ ਦੇਖ ਕੇ ਜਿੱਦਾਂ ਅੱਜ ਕੱਲ੍ਹ ਤਾਂ ਬਾਰਿਸ਼ ਹਾਂਜੀ ਇੱਕ ਬਾਰਿਸ਼ ਬਹੁਤ ਹੋ ਰਹੀ ਸੀਗੀ ਸਾਡੇ ਕੋਲ ਆਇਆ ਨਹੀਂ ਗਿਆ ਇੱਕ ਦੋ ਦਿਨਾਂ 'ਚ ਅਸੀਂ ਪਹੁੰਚਦੇ ਹਾਂ ਹਾਂਜੀ

ਹਾਂਜੀ ਇੱਕ ਦੋ ਦਿਨਾਂ 'ਚ ਫੇਰ ਅਸੀਂ ਆਵਾਂਗੇ ਤੁਹਾਡੇ ਕੋਲ ਹੈ ਨਾ ਅਤੇ ਹਾਂਜੀ ਠੀਕ ਹੈ ਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਓਕੇ ਓਕੇ